ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਹਰੇਕ ਰਾਜ ਦੀ ਜਿਹੜੀ ਆਪਣੀ ਭਾਸ਼ਾ ਹੈ ਉਹਨੂੰ ਮਾਨਤਾ ਲਗਭਗ ਮਿਲੀ ਹੋਈ ਹੈ ਖੇਤਰੀ ਭਾਸ਼ਾ ਜਿਹੜੀ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਕੰਮ ਕੀਤਾ ਜਾਂਦਾ ਉਹ ਖੇਤਰੀ ਭਾਸ਼ਾ ਦੇ ਵਿੱਚ ਹੀ ਕੀਤਾ ਜਾਂਦਾ ਹੈ ਜਿਵੇਂ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਭਾਸ਼ਾ ਜਿਹੜੀ ਖੇਤਰੀ ਸਾਡੀ ਭਾਸ਼ਾ ਪੰਜਾਬੀ ਹੈ ਉਹ ਹੀ ਜਿਹੜੀ ਸਰਕਾਰੀ ਭਾਸ਼ਾ ਹੈ ਦਫ਼ਤਰੀ ਕੰਮ ਸਾਰਾ ਪੰਜਾਬੀ ਵਿੱਚ ਕੀਤਾ ਜਾਂਦਾ ਹੈ

ਲਿਖਤੀ ਰੂਪ 'ਚ ਕੁਛ ਹੋਰ ਹੈ ਅਤੇ ਬੋਲੀ ਜਾਣ ਵਾਲੀ ਹੋਰ ਹੈ ਮਲਵਈ ਪੁਆਧੀ ਦੁਆਬੀ ਇਸ ਤਰੀਕੇ ਦੇ ਨਾਲ ਜਿਹੜੀ ਭਾਸ਼ਾ ਵਿਭਿੰਨਤਾ ਬੜੀ ਜ਼ਿਆਦਾ ਹੈ ਖਿੱਤੇ ਦੇ ਬੇਸ 'ਤੇ ਜਿਵੇਂ ਸੰਗਰੂਰ ਦੀ ਅੰਬਰਸਰੀ ਜਾਂ ਜਲੰਧਰ ਜਿਹੜਾ ਹੈਗਾ ਉਧਰ ਇਲਾਕੇ ਦੀ ਹੋਰ ਤਰ੍ਹਾਂ ਦੀ ਉਹ ਹੈ ਪੁਆਧ ਦੀ ਅਲੱਗ ਹੈ ਉਹਨਾਂ ਦੇ ਸ਼ਬਦ ਹੋਰ ਨੇ ਅਤੇ ਅਸੀਂ ਪਰ ਜਿਹੜੀ ਇੱਕ ਸਾਂਝੀ ਭਾਸ਼ਾ ਸਰਕਾਰੀ ਦਫਤਰਾਂ 'ਚ ਵਰਤੀ ਜਾਂਦੀ ਉਹ ਜਰਨਲ ਪੰਜਾਬੀ ਹੈ ਅਤੇ ਇਸੇ ਤਰ੍ਹਾਂ ਨਾਲ ਹਰੇਕ ਜਿਹੜਾ ਰਾਜ ਹੈ ਸਾਡਾ ਹਰੇਕ ਸਟੇਟ ਹੈ ਜਿਹੜੀ ਭਾਰਤ ਦੀ ਉਹਦੇ ਵਿੱਚ ਬੜੀ ਸਾਰੀ ਵਿਭਿੰਨਤਾ ਹੈ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਕਿਤਾਬੀ ਰੂਪ ਦੇ ਵਿੱਚ ਜਾਂ ਕਿਤਾਬੀ ਭਾਸ਼ਾ ਦੇ ਵਿੱਚ ਨਹੀਂ ਹੈਗੇ ਪਰ ਉਹਨੂੰ ਜਿਹੜੇ ਖੇਤਰੀ ਲੋਕ ਨੇ ਉਹ ਆਪਣੀ ਭਾਸ਼ਾ ਦੇ ਤੌਰ 'ਤੇ ਵ ਅ ਵਰਤਦੇ ਨੇ

ਅਤੇ ਬੜੀਆਂ ਸਾਰੀਆਂ ਹਰੇਕ ਸਟੇਟ ਦੀਆਂ ਅਲੱਗ ਅਲੱਗ ਜਿਹੜੀਆਂ ਮਲਿਆਲੀ ਲੋਕ ਮਲਿਆਲਮ ਬੋਲਦੇ ਨੇ ਤ ਤੇਲਗੂ ਬੋਲਦੇ ਨੇ ਇਹ ਸਾਰੀਆਂ ਸਾਡੀਆਂ ਖੇਤਰੀ ਭਾਸ਼ਾ ਨੇ ਇਹ ਜਿਹੜੀ ਹੁਣ ਇਹਨਾਂ ਨੂੰ ਜਿਹੜਾ ਉਸ ਲੋਕ ਉੱਥੋਂ ਦੇ ਰਹਿਣ ਵਾਲੇ ਨੇ ਉਹ ਤਾਂ ਉਹਨੂੰ ਸਮਝਦੇ ਨੇ ਪਰ ਜੇ ਅਸੀਂ ਆਮ ਜਿਹੜੀ ਉੱਤਰ ਦੱਖਣ ਦੀ ਗੱਲ ਕਰੀਏ ਤਾਂ ਉੱਤਰ ਵਾਲੇ ਲੋਕ ਦੱਖਣ ਦੀ ਭਾਸ਼ਾ ਨਹੀਂ ਸਮਝਣਗੇ ਦੱਖਣ ਵਾਲੇ ਪੰਜਾਬੀ ਨਹੀਂ ਸਮਝਣਗੇ ਇਸ ਤਰ੍ਹਾਂ ਨਾਲ ਸਾਰ ਹਰੇਕ ਜਿਹੜੀ ਇੱਕ ਕਿਹਾ ਜਾਵੇ ਵੀ ਜਨਰਲ ਵਰਤੋਂ ਲਈ ਕਿਹਾ ਜਾਵੇ ਦੇਸ਼ ਦੇ ਵਿੱਚ ਭਾਰਤ ਦੀ ਜਿਹੜੀ ਸਰਕਾਰੀ ਭਾਸ਼ਾ ਉਹ ਹਿੰਦੀ ਹੈ ਰਾਜਾਂ ਦੇ ਬੇਸ 'ਤੇ ਹਰੇਕ ਰਾਜ ਦੀ ਆਪ ਦੀ ਸਰਕਾਰੀ ਭਾਸ਼ਾ ਹੈ ਜੇ ਅਸੀਂ ਕੋਈ ਸਾਂਝਾ ਜਿਹੜਾ ਦਫ਼ਤਰੀ ਡਾਕੂਮੈਂਟ ਭੇਜਣਾ ਤਾਂ ਉਹ ਅਸੀਂ ਹਿੰਦੀ ਦੇ ਵਿੱਚ ਪੜ੍ਹ ਸਕਦੇ ਹਾਂ ਅਤੇ ਬਹੁਤ ਸਾਰੇ ਕਾਗਜ਼ੀ ਕਾਰਵਾਈ ਆ ਜਿਹੜੀ ਉਹ ਇੰਗਲਿਸ਼ 'ਚ ਵੀ ਹੁੰਦੀ ਆ ਅੰਗਰੇਜ਼ੀ ਹੈ ਜਿਹੜੀ ਉਹ ਵੀ ਸਾਡਾ ਮੀਡੀਅਮ ਮਾਧਿਅਮ ਰੱਖੀ ਹੋਈ ਆ ਬਹੁਤ ਸਾਰੀਆਂ ਟੈਕਨੀਕਲ ਜਿਹੜੀ ਹੈਗੀ ਸਾਡੀ ਜਿਹੜੀ ਪੜ੍ਹਾਈ ਹੈ ਜਾਂ ਹੋਰ ਉਹਦਾ ਮਾਧਿਅਮ ਜਿਹੜਾ ਅੰਗਰੇਜ਼ੀ ਹੈ ਇਸ ਕਰਕੇ ਹਿੰਦੀ ਅੰਗਰੇਜ਼ੀ ਜਿਹੜੀਆਂ ਦੋ ਮੇਨ ਭਾਸ਼ਾਵਾਂ ਨੇ ਜਿਹੜੀਆਂ ਸਾਰੇ ਥਾਂ 'ਤੇ ਬਹੁਤ ਸਾਰੇ ਥਾਵਾਂ 'ਤੇ ਜਿਹੜਾ ਸਾ ਸਾਤਰੀ ਕੰਮ ਆ ਉਹ ਅੰਗਰੇਜੀ ਭਾਸ਼ਾ 'ਚ ਹੁੰਦਾ ਪਰ ਜਿਹੜੀ ਮਾਨਤਾ ਮਿਲੀ ਹੋਈ ਆ ਉਹ ਸਾਡੀ ਸਰਕਾਰੀ ਭਾਸ਼ਾ ਦੀ ਉਹ ਹਿੰਦੀ ਹੈ ਪਰ ਉਸ ਤੋਂ ਬਾਅਦ ਜੇ ਅੱਗੇ ਸਟੇਟ ਲੈਵਲ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਹਰੇਕ ਰਾਜ ਦੀ ਆਪਣੀ ਭਾਸ਼ਾ ਹੈ